ਹਾਂਜੀ ਵਿੱਕੀ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋ ਹਾਂਜੀ ਵਿੱਕੀ ਭਾਅ ਜੀ ਅਸੀਂ ਲਵਲੀ ਦੇ ਘਰੋਂ ਬੋਲ ਰਹੇ ਹਾਂ ਅਸੀਂ ਕਿਸ ਪੱਚੀ ਤਰੀਕ ਨੂੰ ਬਾਹਰ ਜਾਣਾ ਹੈ ਕੀ ਤੁਸੀਂ ਸਾਡੇ ਨਾਲ ਚੱਲੋਗੇ ਤੁਸੀਂ ਆਪਣੀ ਕਾਰ ਲੈ ਕੇ ਚੱਲੋਗੇ ਅਸੀਂ ਬੱਸ ਸਟੈਂਡ 'ਤੇ ਸਾਨੂੰ ਛੱਡ ਆਇਓ ਇਸ ਜਗ੍ਹਾ 'ਤੇ ਅਸੀਂ ਪੁੱਜਣਾ ਹੈ ਕਿ ਪੱਚੀ ਤਰੀਕ ਨੂੰ ਅਸੀਂ ਜਾਣਾ ਹੈ ਤੁਸੀਂ ਸਾਨੂੰ ਛੱਡ ਆਓਗੇ ਮੇਰੀ ਪੂਰੀ ਫੈਮਿਲੀ ਮੇਰੇ ਨਾਲ ਜਾਣੀ ਹੈ ਕੋਈ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਕਿਉਂ ਕਿਉਂਕਿ ਤੁਹਾਡੀ ਡਰਾਈਵਰੀ ਬਹੁਤ ਵਧੀਆ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਨੂੰ ਵਧੀਆ ਤਰੀਕੇ ਨਾਲ ਹੀ ਖੜ੍ਹੋਗੇ ਹਾਂਜੀ ਸਾਨੂੰ ਵਿਸ਼ਵਾਸ ਹੈ ਤੁਹਾਡੇ 'ਤੇ ਤੁਸੀਂ ਮੇਰੀ ਫੈਮਿਲੀ ਨੂੰ ਕੋਈ ਵੀ ਤੰਗੀ ਨਹੀਂ ਆ ਦਿਓਗੇ ਤੁਹਾਡੀ ਡਰਾਈਵਰੀ ਬਹੁਤ ਵਧੀਆ ਹੈ ਕੋਈ ਵੀ ਐਕਸੀਡੈਂਟ ਵਗੈਰਾ ਅਸੀਂ ਕਦੀ ਨਹੀਂ ਸੁਣਿਆ ਤੁਸੀਂ ਮੈਂ ਸਾਨੂੰ ਇਸ ਪਤੇ 'ਤੇ ਪਤਾ ਪਹੁੰਚਾ ਦੇਣਾ ਤਾਂ ਕਿ ਸਾਨੂੰ ਕੋਈ ਵੀ ਦਿੱਕਤ ਨਾ ਹੋ ਸਕੇ ਮੇਰੀ ਫੈਮਿਲੀ ਵੀ ਆ ਅਸੀਂ ਮਾਡਲ ਟਾਊਨ ਜਾਣਾ ਹੈ ਤੁਸੀਂ ਸਾਨੂੰ ਛੱਡ ਕੇ ਆਓਗੇ ਕੋਈ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਸਾਨੂੰ ਤੁਹਾਡੇ ਏ ਨਾਲ ਅਸੀਂ ਵਧੀਆ ਜਾਵਾਂਗੇ ਸਾਨੂੰ ਵਿਸ਼ਵਾਸ ਹੈ ਤੁਹਾਡੇ 'ਤੇ ਕਿ ਤੁਸੀਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਉੱਥੇ ਪਹੁੰਚਾ ਦਿਓਗੇ ਇਸ ਲਈ ਅਸੀਂ ਤੁਹਾਨੂੰ ਹੀ ਕਹਿ ਸਾ ਤੁਹਾਡੇ 'ਤੇ ਸਾਨੂੰ ਵਿਸ਼ਵਾਸ ਹੈ ਤੁਹਾਡੀ ਡਰਾਈਵਰੀ ਚੰਗੀ ਹੈ ਤੁਸੀਂ ਸਾਨੂੰ ਇਸ ਪਤੇ 'ਤੇ ਪਹੁੰਚਾ ਦੇਣਾ ਤਾਂ ਕਿ ਸਾਨੂੰ ਕੋਈ ਵੀ ਦਿੱਕਤ ਨਾ ਆ ਸਕੇ ਇਸ ਲਈ ਅਸੀਂ ਤੁਹਾਡੀ ਕਾਰ ਕਰਵਾਈ ਹੈ ਤਾਂ ਕਿ ਤੁਹਾਡੀ ਡਰਾਈਵਰੀ ਬਹੁਤ ਸਾਫ ਹੈ ਤੁਸੀਂ ਸਾਨੂੰ ਬਹੁਤ ਟਾਈਮ 'ਤੇ ਪੱਕਾ ਪਹੁੰਚਾ ਦਿਓਗੇ ਇਸ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਚੱਲੋਗੇ ਮੇਰੀ ਫੈਮਲੀ ਵੀ ਹੈ ਉਹ 'ਚ ਪੰਜ ਛੇ ਜਣੇ ਹੈ ਮੇਰੇ ਘਰ ਦੀ ਫੈਮਲੀ ਸਾਨੂੰ ਛੱਡ ਆਓ ਛੱਡ ਆਓਗੇ